ਸਮੇਂ ਦੇ ਵਧਣ ਨਾਲ ਪੇਂਡੂ ਲੋਕਾਂ ਦੀ ਵੀ ਖੇਡਾਂ ਵੱਲ ਦਿਲਚਸਪੀ ਵੱਧਦੀ ਜਾ ਰਹੀ ਹੈ ਜਿਵੇਂ ਕਿ ਅਸੀਂ ਦੇਖ ਸਕਦੇ ਹਾਂ ਅੱਜ ਕੱਲ੍ਹ ਪਿੰਡਾਂ ਦੇ ਵਿੱਚ ਲੋਕ ਹੁਣ ਵੱਧ ਚੜ੍ਹ ਕੇ ਖੇਡਾਂ ਵਿੱਚ ਹਿੱਸਾ ਲੈ ਰਹੇ ਹਨ ਜਿਵੇਂ ਕਿ ਕਬੱਡੀ ਟੂਰਨਾਮੈਂਟ ਪਿੰਡਾਂ ਵਿੱਚ ਹੋ ਰਹੇ ਹਨ ਜਿਹਨਾਂ ਵਿੱਚ ਵੱਖ ਵੱਖ ਜ਼ਿਲ੍ਹਿਆਂ ਦੀਆਂ ਟੀਮਾਂ ਭਾਗ ਲੈਂਦੀਆਂ ਹਨ ਤੇ ਜੇਤੂ ਟੀਮ ਨੂੰ ਇਨਾਮ ਦਿੱਤਾ ਜਾਂਦਾ ਹੈ ਇਹ ਸਭ ਪਿੰਡਾਂ ਦੀਆਂ ਹੀ ਔਰਗਨਾਈਜੇਸ਼ਨਾਂ ਦੁਆਰਾ ਕੀਤਾ ਜਾਂਦਾ ਹੈ ਉਸ ਤੋਂ ਇਲਾਵਾ ਉਹ ਪਿੰਡਾਂ ਵਿੱਚ ਇਕੱਲੀ ਕਬ ਕਬੱਡੀ ਹੀ ਨਹੀਂ ਕ੍ਰਿਕਟ ਟੂਰਨਾਮੈਂਟ ਵਾਲੀਵੋੋਲ ਟੂਰਨਾਮੈਂਟ ਅਤੇ ਹੋਰ ਕਈ ਪ੍ਰਕਾਰ ਦੇ ਖੇਡਾਂ ਦੇ ਟੂਰਨਾਮੈਂਟ ਹੋ ਰਹੇ ਹਨ ਜਿਸ ਨਾਲ ਪਿੰਡਾਂ ਦੇ ਨੌਜਵਾਨ ਅਤੇ ਬਜ਼ੁਰਗਾਂ ਦਾ ਮਨੋਰੰਜਨ ਵੀ ਹੁੰਦਾ ਹੈ ਅਤੇ ਉਹ ਬੁਰੀਆਂ ਚੀਜ਼ਾਂ ਤੋਂ ਦੂਰ ਰਹਿੰਦੇ ਹਨ ਤਾਂ ਕਿ ਉਹਨਾਂ ਦੀ ਸਿਹਤ ਸਹੀ ਰਹਿ ਸਕੇ ਅਤੇ ਉਹ ਹੁਣ ਇੱਕ ਨਵਾਂ ਹੀ ਜੀਵਨ ਅਪਨਾ ਰਹੇ ਹਨ